ਛੋਟੇ ਕਾਰੋਬਾਰ ਅਜਿਹੇ ਕਾਰੋਬਾਰ ਹੁੰਦੇ ਹਨ ਜੋ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਚਲਾਏ ਜਾਂਦੇ ਹਨ ਪਿੰਡ ਦੇ ਲੋਕ ਆਪਣੇ ਘਰ ਦੇ ਵਿੱਚ ਹੀ ਇਨ੍ਹਾਂ ਨੂੰ ਕਾਰੋਬਾਰਾਂ ਨੂੰ ਸ਼ੁਰੂ ਕਰ ਲੈਂਦੇ ਹਨ ਜਿਵੇਂ ਕਿ ਡੇਅਰੀ ਫਾਰਮ ਸਿਲਾਈ ਕਢਾਈ ਅਤੇ ਆਟੇ ਦੀ ਚੱਕੀ ਆਦਿ ਡੇਅਰੀ ਫਾਰਮ ਦੇ ਵਿੱਚ ਪਿੰਡ ਦੇ ਸਾਰੇ ਲੋਕ ਦੁੱਧ ਪਾ ਕੇ ਵੀ ਜਾਂਦੇ ਹਨ ਅਤੇ ਉੱਥੋਂ ਦੁੱਧ ਲੈ ਕੇ ਵੀ ਜਾਂਦੇ ਹਨ ਇਸਦੇ ਨਾਲ ਹੀ ਉਹ ਆਪਣੀਆਂ ਮੱਝਾਂ ਗਾਵਾਂ ਦੇ ਲਈ ਫੀਡ ਦੇ ਗੱਟੇ ਅਤੇ ਦਵਾਈਆਂ ਆਦਿ ਉੱਥੋਂ ਡੇਅਰੀ ਫਾਰਮ ਤੋਂ ਲੈ ਕੇ ਜਾ ਸਕਦੇ ਹਨ ਇਸਦੇ ਨਾਲ ਹੀ ਸਿਲਾਈ ਕਢਾਈ ਪਿੰਡ ਦੇ ਵਿੱਚ ਵ ਵਧੀਆ ਕੀਤੀ ਜਾ ਸਕਦੀ ਹੈ ਮੈਂ ਵੀ ਆਪਣਾ ਸਿਲਾਈ ਕਢਾਈ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਇਸਦੇ ਵਿੱਚ ਮੈਂ ਸੂਟਾਂ ਦੇ ਅਲੱਗ ਅਲੱਗ ਡਿਜਾਇਨ ਬਣਾਉਂਦੀ ਹਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਪੇਂਟ ਕਰਕੇ ਅਪ ਆਪਣੇ ਸੂਟ ਡਿਜਾਇਨ ਕਰਦੀ ਹਾਂ ਇਸ ਕਾਰੋਬਾਰ ਦੇ ਨਾਲ ਮੈਨੂੰ ਆਮਦਨੀ ਵੀ ਬਹੁਤ ਹੁੰਦੀ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਪਿੰਡ ਦੇ ਕਈ ਇਸਤਰੀਆਂ ਮੇਰੇ ਕੋਲ ਆਣ ਕੇ ਸੂਟ ਪੇਂਟ ਕਰਵਾਉਂਦੀਆਂ ਕਢਾਈ ਕਰਵਾਉਂਦੀਆਂ ਅਤੇ ਉਨ੍ਹਾਂ ਨੂੰ ਮੈਂ ਕਰਕੇ ਵੀ ਦਿੰਦੀ ਹਾਂ ਅਤੇ ਸਟਿੱਚ ਵੀ ਕਰਦੀ ਹਾਂ ਇਸਦੇ ਨਾਲ ਮੈਨੂੰ ਉਹ ਆਮ ਪੈਸੇ ਦੇ ਕੇ ਜਾਂਦੀਆਂ ਹਨ ਅਤੇ ਮੈਨੂੰ ਉਹ ਆਮਦਨੀ ਤੋਂ ਮੈਂ ਆਪਣੇ ਨਿੱਕੇ ਮੋਟੇ ਖਰਚੇ ਅਤੇ ਕਈ ਹੋਰ ਵੱਡੇ ਪ੍ਰਕਾਰ ਦੇ ਖਰਚੇ ਪੂਰੇ ਕਰ ਲੈਂਦੀ ਹਾਂ